ਹੈਲੋ ਕੀ ਹਾਲ ਆ ਵੀਰ ਜੀ ਹੋਰ ਠੀਕ ਹੋ ਮੇਰਾ ਨਾਮ ਹਰਚੰਦ ਸਿੰਘ ਆ ਵੀਰੇ ਅਤੇ ਅਸੀਂ ਹੰਡਿਆਏ ਤੋਂ ਬੋਲਦੇ ਹਾਂ ਵੀਰੇ ਹਾਂਜੀ ਸਰ ਸ਼ਰਮਾ ਟੈਲੀਕੋਮ ਤੋਂ ਹਾਂਜੀ ਹਾਂ ਅਤੇ ਆਪਣਾ ਨਾ ਇੱਕ ਮੋਬਾਇਲ ਆ ਵੀਰੇ ਸੈਮਸੰਗ ਕੰਪਨੀ ਦਾ ਹਾਂਜੀ ਉਹ ਮੌਡਲ ਮਾਡਲ ਇਹ ਏ ਏ ਏ ਏ ਸੀਰੀਜ਼ ਆ ਹਾਂ ਜੀ ਐਸੇ ਹੀ ਆ ਕੁਛ ਏ ਸੀਰੀਜ਼ ਹਾਂਜੀ ਹਾਂ ਉਹਦੇ ਨਾ ਥੋੜ੍ਹੀ ਜਿਹੀ ਮਾਇਕ ਦੀ ਪ੍ਰੋਬਲਮ ਆ ਇੱਕ ਤਾਂ ਅਤੇ ਆਵਾਜ਼ ਸਹੀ ਜਿਹੀ ਸਹੀ ਨਹੀਂ ਮਤਲਬ ਜਾਂਦੀ ਹੈਗੀ ਅੱਗੇ ਅਤੇ ਇੱਕ ਉਹਦੇ 'ਚ ਜੈੱਕ ਦੀ ਪ੍ਰੋਬਲਮ ਆ ਗਈ ਅਤੇ ਮਤਲਬ ਚਾਰਜਰ ਵੀ ਉਹਦਾ ਸਹੀ ਤਰੀਕੇ ਨਾਲ ਨਹੀਂ ਲੱਗਦਾ ਹੈਗਾ ਤਾਂ ਉਹਦੇ ਬਾਰੇ ਥੋੜ੍ਹਾ ਜਿਹਾ ਉਹ ਕਰਨਾ ਸੀਗਾ ਆਪਾਂ ਹਾਂ ਬੱਚੇ ਵੀ ਕਈ ਵਾਰ ਮ ਮਤਲਬ ਉਹ ਕਰਦੇ ਨੇ ਇਹ ਯੂਸ ਕਰ ਲੈਂਦੇ ਨੇ ਇਹਨੂੰ ਤਾਂ ਕਰਕੇ ਹਾਂਜੀ ਹਾਂ ਹਾਂਜੀ ਹਾਂ ਅਤੇ ਹਾਂਜੀ ਇੱਕ ਦਮ ਮਾਇਕ ਦੀ ਪ੍ਰੋਲਮ ਆ ਗਈ ਇੱਕ ਥੋੜ੍ਹੀ ਜਿਹੀ ਜੈੱਕ ਦੀ ਪ੍ਰੋਬਲਮ ਆ ਗਈ ਹਾਂਜੀ ਚਾਰਜਰ ਮਤਲਬ ਸਹੀ ਢੰਗ ਨਾਲ ਨਹੀਂ ਲੱਗਦਾ ਉਹਦਾ ਕਈ ਵਾਰੀ ਹਿੱਲ ਜਾਂਦਾ ਗਾ ਮਤਲਬ ਚਾਰਜ ਕਰਨੋਂ ਹੱਟ ਜਾਂਦਾ ਗਾ ਬੰਦ ਹੋ ਜਾਂਦਾ ਚਾਰਜ ਕਰਨੋਂ ਹਾਂਜੀ ਹਾਂ ਅਤੇ ਨਹੀਂ ਮਾਈਕ ਦੀ ਮਤਲਬ ਅੱਗੇ ਨਹੀਂ ਸੁਣਦੀ ਹੈਗੀ ਇਧਰੋਂ ਤਾਂ ਜਾਂਦੀ ਹੀ ਨਹੀਂ ਹੈਗੀ ਮਤਲਬ ਅਗਲੇ ਬੰਦੇ ਕੋਲ ਹਾਂਜੀ ਉਹ ਸੁਣਾਈ ਦੇ ਜਾਂਦੀ ਹੈਗੀ ਮਤਲਬ ਜਿਹੜੀ ਆਪਣੀ ਆਵਾਜ਼ ਹੈਗੀ ਉਹ ਅੱਗੇ ਨਹੀਂ ਜਾਂਦੀ ਹੈਗੀ ਹਾਂਜੀ ਹਾਂ ਇੱਥੋਂ ਆਪਣੇ ਮਤਲਬ ਇੱਕ ਮਿੱਤਰ ਹੈਗਾ ਅਤੇ ਉਹਨਾਂ ਨੇ ਤੁਹਾਡਾ ਫੋਨ ਮਤਲਬ ਠੀਕ ਕਰਵਾਏ ਸੀ ਰਿਪੇਅਰ ਕਰਵਾਏ ਸੀ ਜੀ ਅਤੇ ਉਹਨਾਂ ਦੇ ਹਾਂਜੀ ਹਾਂ ਉਹਨਾਂ ਦੇ ਰੇਫ੍ਰਨ੍ਸ 'ਤੇ ਹੀ ਅਸੀਂ ਕੋਲ ਕੀਤੀ ਆ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਕਿੱਥੇ ਜਿਹੇ ਮਤਲਬ ਮਤਲਬ ਅਡਰੈ ਹੰਡਾਯੇ ਤੋਂ ਬਰਨਾਲੇ ਨੂੰ ਜਾਵਾਂਗੇ ਹਾਂਜੀ

ਅੱਛਾ ਜੀ ਕਚੇਰੀ ਕਚਹਿਰੀਆਂ ਦੇ ਮਤਲਬ ਨ ਨਜ਼ਦੀਕ ਹੀ ਹੈ ਅੱਛਾ ਜੀ ਅੱਛਾ ਜੀ ਹਾਂਜੀ ਹਾਂ ਮੇਰੇ ਕੋਲ ਹੈਗਾ ਜੀ ਆਪਣੇ ਕੋਲ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਜੀ ਤਾਂ ਮਤਲਬ ਅੱਛਾ ਦਸ ਕੁ ਮਿੰਟਾ 'ਚ ਹੀ ਹੋਜੂ ਗਾ ਜੀ ਅੱਛਾ ਜੀ ਅੱਛਾ ਜੀ ਮਤਲਬ ਜੇ ਆਪਾਂ ਇਹਨੂੰ ਸੈਂਟਰ ਦੇ ਵਿੱਚ ਭੇਜਦੇ ਹਾਂ ਫਿਰ ਕਿੰਨਾ ਕੁ ਸਮਾਂ ਲੱਗ ਜੂਗਾ ਆਪਾਂ ਨੂੰ ਅੱਛਾ ਜੀ ਚਾਰ ਪੰਜ ਦਿਨ ਲੱਗ ਜਾਂਦੇ ਆ ਮਤਲਬ ਹਾਂ ਅੱਛਾ ਜੀ ਅੱਛਾ ਜੀ ਅੱਛਾ ਅਤੇ ਇੱਕ ਨਾ ਥੋੜ੍ਹੀ ਜਿਹੀ ਹੋਰ ਪ੍ਰੋਬਲਮ ਆ ਆਪਣੀ ਮਤਲਬ ਜਿਹੜਾ ਸਿਮ ਆ ਨਾ ਜਿੱਥੇ ਆਪਾਂ ਸਿਮ ਪੈਂਦਾ ਗਾ ਨਾ ਕਈ ਵਾਰ ਨਾ ਸਿਮ ਨਾ ਹਿੱਲ ਜਾਂਦਾ ਗਾ ਮਤਲਬ ਨੈਟਵਰਕ ਸ਼ੋਅ ਕਰਨੋਂ ਹਟ ਜਾਂਦਾ ਗਾ ਇਹ ਵੀ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਇੱਕ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਅਸੀਂ ਮਤਲਬ ਅੱਛਾ ਜੀ ਅੱਛਾ ਮਤਲਬ ਕਿੰਨੇ ਕੁ ਵਜੇ ਤੋਂ ਲੈ ਕੇ ਕਿੰਨੇ ਕੁ ਵਜੇ ਤੱਕ ਸੈਂਟਰ ਦੇ ਵਿੱਚ ਮੈਂ ਪਹੁੰਚ ਕਰ ਸਕਦਾਂ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਹਾਂਜੀ ਚਲੇ ਜਾਂਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਅੱਛਾ ਜੀ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਕਰਦਾ ਜੀ ਗੱਲ ਓਕੇ ਜੀ ਥੈਂਕ ਯੂ ਧੰਨਵਾਦ ਜੀ ਓਕੇ